ਸਤਿ ਸ਼੍ਰੀ ਆਕਾਲ ਭਾਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸੋਰੀ ਭਾਅ ਜੀ ਕੋਈ ਗੱਲ ਨਹੀਂ ਜੇ ਤੁਸੀਂ ਆਪਣੇ ਸੇਬ ਲੈ ਆਓ ਮੈਂ ਵਾਪਸ ਕਰ ਲਾਂਗਾ ਆਪਣੀ ਗਲਤੀ ਮੈਂ ਮਨਜ਼ੂਰ ਕਰਨਾ ਮੈਂ ਤੁਹਾਨੂੰ ਦੂਸਰੇ ਸੇਬ ਕਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਲਓ ਕੋਈ ਗੱਲ ਨਹੀਂ ਅੱਧੇ ਘੰਟੇ ਤੱਕ ਆ ਜੋ ਦੁਕਾਨ ਸਾਡੀ ਸਵੇਰੇ ਨੌਂ ਵਜੇ ਤੋਂ ਲੈ ਕੇ ਸ਼ਾਮ ਦੇ ਨੌਂ ਵਜੇ ਤੱਕ ਖੁੱਲ੍ਹੀ ਹੁੰਦੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਰ ਮਾਫੀ ਚਾਹੁੰਦਾ ਮੈਂ ਜਿਹੜੇ ਗਲਤ ਫਰੂਟ ਨਿਕਲ ਗਿਆ ਹਾਂਜੀ ਹਾਂਜੀ ਹਾਂਜੀ ਹਾਂਜੀ